ਦੇਖਿਆ ਜਾਵੇ ਤਾਂ ਅੱਜ ਕੱਲ੍ਹ ਮਾਰਕਿਟ ਵਿੱਚ ਬਣੇ ਬਣਾਏ ਕੱਪੜੇ ਵੀ ਮਿਲ ਜਾਂਦੇ ਹਨ ਪਰ ਉਨ੍ਹਾਂ ਦੀ ਫਿਟਿੰਗ ਓਨੀ ਵਧੀਆ ਨਹੀਂ ਹੁੰਦੀ ਜਿੰਨੀ ਫਿਟਿੰਗ ਆਪਾਂ ਆਪਣਾ ਕੱਪੜਾ ਲੈ ਕੇ ਸਵਾਨੇ ਹਨ ਉਨ੍ਹਾਂ ਦੀ ਫਿਟਿੰਗ ਵੀ ਬਹੁਤ ਵਧੀਆ ਆਉਂਦੀ ਹੈ ਅਤੇ ਦੇਖਣ 'ਚ ਵੀ ਵਧੀਆ ਲੱਗਦੇ ਹਨ ਅਤੇ ਮਾਰਕਿਟ ਦੇ ਕੱਪੜੇ ਆਪਾਂ ਨੂੰ ਮਿਲਦੇ ਵੀ ਥੋੜ੍ਹੇ ਮਹਿੰਗੇ ਹਨ ਅਤੇ ਉਨੀ ਫਿਟਿੰਗ ਵੀ ਅੱਛੀ ਨਹੀਂ ਆਉਂਦੀ ਜਿੰਨੀ ਆਪਾਂ ਆਪਣੇ ਕੋਲ਼ ਬਣਵਾ ਕੇ ਕਰਦੇ ਹਨ ਅਤੇ ਮਿਲ ਵੀ ਸਸਤੇ ਜਾਂਦੇ ਹਨ